ਹੈਲੋ ਮੈਂ ਰਾਜ ਕੁਮਾਰੀ ਬੋਲ ਰਹੀ ਹਾਂ ਮੇਰਾ ਮੋਬਾਈਲ ਨੰਬਰ ਅੱਠ ਤਿੰਨ ਛੇ ਜੀਰੋ ਚਾਰ ਜੀਰੋ ਅੱਠ ਦੋ ਛੇ ਚਾਰ ਹੈ ਕਿਰਪਾ ਕਰਕੇ ਮੈਨੂੰ ਇਸਦੀ ਪਲਾਨ ਬਾਰੇ ਵੈਲਡਿਟੀ ਦੇ ਪਲਾਨ ਬਾਰੇ ਡਾਟਾ ਬਾਰੇ ਜਾਣਕਾਰੀ ਦਿੱਤੀ ਜਾਵੇ ਹਾਂਜੀ ਇੱਕ ਸੌ ਸਤਾਨਵੇਂ ਵਿੱਚ ਕਿੰਨਾ ਕਿੰਨਾ ਮਿਲੇਗਾ ਡਾਟਾ ਦੋ ਜੀਬੀ ਏ ਤੁਸੀਂ ਮੈਨੂੰ ਸਾਰੇ ਸਾਲ ਦੀ ਦਾ ਦੱਸ ਸਕਦੇ ਜੇ ਡਾਟਾ ਕਿੰਨਾ ਹੋਵੇਗਾ ਕਿੰਨਾ ਡਾਟਾ ਮਿਲੇਗਾ ਉਹਦੇ 'ਚ ਵੈਲਡਿਟੀ ਕੀ ਹੋਵੇਗੀ ਟਾਕਟਾਈਮ ਕਿੰਨਾ ਹੋਵੇਗਾ ਅਤੇ ਕਿੰਨੇ ਮੈਸਿਜ ਸੈਂਡ ਕਰ ਸਕਦੇ ਹਾਂ ਦੋ ਹਜ਼ਾਰ ਨੌਂ ਸੌ ਨੜਿਨਵੇਂ ਰੁਪਏ

ਤੁਸੀਂ ਮੈਨੂੰ ਵੈਲਡਿਟੀ ਜਿ ਜਿਸ ਤਿੰਨ ਤਿੰਨ ਮਹੀਨੇ ਹੋਵੇ ਉਸ ਬਾਰੇ ਜਾਣਕਾਰੀ ਦਿਓ ਠੀਕ ਹੈ ਤੁਸੀਂ ਅੱਛਾ ਉਸ ਵਿੱਚ ਟਾਕਟਾਈਮ ਜਿਹੜਾ ਹੈ ਥਰਟੀ ਡੇਸ ਠੀਕ ਹੈ ਕੀ ਮੈਂ ਮੇਰਾ ਪਹਿਲਾਂ ਇੱਕ ਪਲਾਨ ਚੱਲ ਰਿਹਾ ਹੈ ਉਸ ਦੇ ਉੱਪਰ ਮੈਂ ਦੂਸਰਾ ਪਲਾਨ ਲੈ ਸਕਦੀ ਹਾਂ ਅੱਗੋਂ ਕੋਂਟੀਨਿਊ ਹੋ ਜਾਵੇਗੀ ਉਹ ਵਾਲੇ ਮੇਰੇ ਪੈਸੇ ਜਿਹੜੇ ਉਹ ਅਗਲੇ ਅਕਾਊਂਟ 'ਚ ਆ ਜਾਣਗੇ ਠੀਕ ਹੈ ਫਿਰ ਤੁਸੀਂ ਮੇਰਾ ਪਲਾਨ ਜਿਹੜਾ ਹੈ ਵੈਲਡਿਟੀ ਜਿਹਦੇ ਵਿੱਚ ਛੇ ਮਹੀਨੇ ਹੋਵੇ ਉਹ ਕਰ ਦਿਓ ਤਿੰਨ ਸੌ ਸਤਾਨਵੇਂ ਰੁਪਏ ਅੱਛਾ ਜੀ ਠੀਕ ਹੈ ਤਿੰਨ ਸੌ ਸਤਾਨਵੇਂ ਰੁਪਏ ਵਾਲਾ ਮੇਰਾ ਪਲਾਨ ਜਿਹੜਾ ਹੈ ਕਰ ਦਿਓ ਰੀਚਾਰਜ ਕਰ ਦਿਓ ਉਸਦਾ ਅਤੇ ਮੋਬਾਈਲ ਨੰਬਰ ਮੇਰਾ ਉਹ ਹੀ ਅੱਠ ਤਿੰਨ ਛੇ ਜੀਰੋ ਚਾਰ ਜੀਰੋ ਅੱਠ ਦੋ ਛੇ ਚਾਰ ਹੈ ਓਕੇ ਜੀ